ਮੇਰੇ ਅਨੁਮਾਨ ਅਨੁਸਾਰ ਪੰਜਾਬੀ ਭਾਸ਼ਾ ਅਤੇ ਬੋਡੋ ਅਤੇ ਬੰਗਾਲੀ ਭਾਸ਼ਾ ਵਿੱਚ ਕੋਈ ਖਾਸ ਸਬੰਧ ਨਹੀਂ ਹੈ ਕਿਉਂਕਿ ਪੰਜਾਬੀ ਭਾਸ਼ਾ ਪੰਜਾਬ ਦੇ ਅ ਪੰਜਾਬ ਅਤੇ ਪਾਕਿਸਤਾਨ ਵਿੱਚ ਬੋਲੀ ਜਾਂਦੀ ਹੈ ਅਤੇ ਬੋਡੋ ਅਤੇ ਬੰਗਾਲੀ ਭਾਸ਼ਾ ਤਿੱਬਤ ਅਤੇ ਬੰਗਲਾਦੇਸ਼ ਵਿੱਚ ਬੋਲੀ ਜਾਂਦੀ ਹੈ ਇਸ ਤੋਂ ਇਲਾਵਾ ਪੰਜਾਬੀ ਭਾਸ਼ਾ ਦੀ ਲਿਪੀ ਗੁਰਮੁਖੀ ਲਿਪੀ ਹੈ ਪਰ ਬੋਡੋ ਅਤੇ ਬੰਗਾਲੀ ਭਾਸ਼ਾ ਦੀ ਲਿਪੀ ਦੇਵਨਗਰੀ ਹੈ ਇਸ ਤੋਂ ਇਲਾਵਾ ਪੰਜਾਬੀ ਭਾਸ਼ਾ ਬੋਡੋ ਅਤੇ ਬੰਗਾਲੀ ਸੰਵਿਧਾਨ ਦੇ ਵਿੱਚ ਮਾਨਤਾ ਪ੍ਰਾਪਤ ਭਾਸ਼ਾਵਾਂ ਵਿੱਚੋਂ ਹਨ ਅਤੇ ਇਹ ਭਾਸ਼ਾ ਇਹ ਭਾਸ਼ਾਵਾਂ ਬਾਈ ਗਿਣਤੀ ਵਿੱਚ ਆਉਂਦੀਆਂ ਹਨ ਇਸ ਤੋਂ ਇਲਾਵਾ ਪੰਜਾਬੀ ਭਾਸ਼ਾ ਬੋਡੋ ਅਤੇ ਬੰਗਾਲੀ ਨਾਲੋਂ ਬੋਲਣੀ ਕਿਤੇ ਜ਼ਿਆਦਾ ਸੌਖੀ ਹੈ ਇਸ ਤੋਂ ਇਲਾਵਾ ਬੋਡੋ ਅਤੇ ਬੰਗਾਲੀ ਥੋੜ੍ਹਾ ਜਿਹਾ ਸਬੰਧ ਉਰਦੂ ਨਾਲ ਵੀ ਰੱਖਦੀਆਂ ਹਨ